ਭਾਰਤ ਵਿੱਚ ਡਾਂਸਰਾਂ 'ਤੇ ਬੋਲੀਵੁੱਡ ਦਾ ਬਹੁਤ ਜ਼ਿਆਦਾ ਪ੍ਰਭਾਵ ਪਿਆ ਹੈ ਜਿਸ ਨਾਲ ਭਾਰਤ ਵਿੱਚ ਡਾਂਸਰਾਂ ਅਤੇ ਬਾਲੀਵੁੱਡ ਵਿੱਚ ਫਿਲਮਾਂ ਬਣਾਈਆਂ ਜਾਂਦੀਆਂ ਹਨ ਦੇ ਡਾਂਸਰਾਂ ਨੂੰ ਇੱਕ ਮੌਕਾ ਦਿੱਤਾ ਜਾਂਦਾ ਹੈ ਤਾਂ ਕਿ ਜੋ ਪੰਜਾਬ ਅਤੇ ਭਾਰਤ ਵਿੱਚ ਬਾਲੀਵੁੱਡ ਫਿਲਮਾਂ ਬਣਦੀਆਂ ਹਨ ਉਹਨਾਂ ਵਿੱਚ ਹਿੱਸਾ ਲੈ ਸਕਣ ਜਿੱਦਾਂ ਕਿ ਅਸੀਂ ਭਾਰਤ ਵਿੱਚ ਦੇਖਿਆ ਕਿ ਡਾਂਸਰਾਂ ਦੀ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈ ਬਾਲੀਵੁੱਡ ਵਿੱਚ ਡਾਂਸਰਾਂ ਦੀ ਲੋੜ ਦੇ ਨਾਲ ਭਾਰਤ ਵਿੱਚ ਭੰਗੜਾ ਗਿੱਧਾ ਹਰ ਇੱਕ ਤਿਉਹਾਰ 'ਤੇ ਡਾਂਸਰ ਸ਼ਾਮਲ ਹੁੰਦੇ ਹਨ ਜੋ ਲੋਕਾਂ ਦਾ ਮਨੋਰੰਜਨ ਕਰਦੇ ਹਨ ਅਤੇ ਉਹਨਾਂ ਦੇ ਦਿਲਾਂ ਉੱਤੇ ਰਾਜ ਕਰਦੇ ਹਨ ਜੋ ਡਾਂਸਰ ਭਾਰਤ ਵਿੱਚ ਆਪਣਾ ਨਾਮ ਬਣਾ ਚੁੱਕੇ ਹਨ ਅਤੇ ਉਹ ਹਰ ਥਾਂ ਉੱਤੇ ਜਾ ਕੇ ਲੋਕਾਂ ਦਾ ਮਨੋਰੰਜਨ ਕਰਦੇ ਹਨ ਇਸ ਨਾਲ ਚੰਗੇ ਡਾਂਸਰ ਪੈਸੇ ਵੀ ਬਣਾਉਂਦੇ ਹਨ ਅਤੇ ਆਪਣਾ ਨਾਮ ਵੀ ਚਮਕਾਉਂਦੇ ਹਨ ਚੰਗੇ ਡਾਂਸਰ ਭਾਰਤ ਦੀਆਂ ਫਿਲਮਾਂ ਵਿੱਚ ਵੀ ਹਿੱਸਾ ਲੈਂਦੇ ਹਨ ਅਤੇ ਉਹ ਲੋਕਾਂ ਦੇ ਦਿਲਾਂ ਉੱਤੇ ਰਾਜ ਕਰਦੇ ਹਨ ਅਤੇ ਵਧੀਆ ਵਧੀਆ ਫਿਲਮਾਂ ਬਣਾਉਂਦੇ ਹਨ ਅਤੇ ਉਹ ਪੈਸਾ ਕਮਾਉਣ ਦੇ ਨਾਲ ਨਾਲ ਲੋਕਾਂ ਦਾ ਮਨੋਰੰਜਨ ਕਰਕੇ ਇੱਕ ਆਪਣੇ ਲੋਕਾਂ ਦੇ ਦਿਲਾਂ ਉੱਤੇ ਸ਼ਾਪ ਛੱਡਦੇ ਹਨ ਡਾਂਸਰਾਂ ਦੇ ਨਾਲ ਭਾਰਤ ਵਿੱਚ ਗੀਤਕਾਰ ਵੀ ਚੰਗੇ ਗੀਤ ਗਾ ਕੇ ਚੰਗੇ ਪੈਸੇ ਕਮਾਉਂਦੇ ਹਨ ਅਤੇ ਲੋਕਾਂ ਦਾ ਮਨੋਰੰਜਨ ਕਰਦੇ ਹਨ ਭਾਰਤ ਵਿੱਚ ਹਿੰਦੀ ਪੰਜਾਬੀ ਅਤੇ ਬਾਕੀ ਕਈ ਹਰ ਤਰ੍ਹਾਂ ਦੇ ਗੀਤ ਗਾਏ ਜਾਂਦੇ ਹਨ ਪੰਜਾਬ ਵਿੱਚ ਲੋਕ ਨਾਚ ਹੈ ਅਤੇ ਹਿੰਦੀ ਵਿੱਚ ਸੰਸਕ੍ਰਿਤਿਕ ਗੀਤ ਅਤੇ ਪੰਜਾਬ ਵਿੱਚ ਲੋਕ ਕਲਾ ਗੀਤ ਵੀ ਗਾਏ ਜਾਂਦੇ ਹਨ ਅਤੇ ਅੱਜ ਕੱਲ੍ਹ ਹੁਣ ਤਾਂ ਬਾਲੀਵੁੱਡ ਵਿੱਚ ਰੈਪ ਵੀ ਆਉਂਦੇ ਹਨ ਜਿਸ ਵਿੱਚ ਬਹੁਤ ਹੀ ਫੇਮਸ ਕਲਾਕਾਰ ਹਨ ਜੋ ਜੋ ਹਨੀ ਸਿੰਘ ਗੁਰਦਾਸ ਮਾਨ ਹਰਭਜਨ ਮਾਨ ਇਹ ਬੁਹਤ ਹੀ ਚੰਗੇ ਗੀਤਕਾਰ ਹਨ ਜਿਹਨਾਂ ਦਾ ਲੋਕਾਂ ਉੱਤੇ ਦਿਲਾਂ ਉੱਤੇ ਬਹੁਤ ਰਾਜ ਹੈ ਅਤੇ ਉਹ ਵਿਆਹ ਸ਼ਾਦੀਆਂ ਅਤੇ ਰੀਤੀ ਰਿਵਾਜ਼ਾਂ ਵਿੱਚ ਸ਼ਾਮਲ ਹੁੰਦੇ ਹਨ ਅਤੇ ਬਹੁਤ ਵਧੀਆ ਗੀਤ ਗਾਉਂਦੇ ਹਨ ਜਿਸ ਨਾਲ ਲੋਕ ਨੱਚਦੇ ਟੱਪਦੇ ਅਤੇ ਖੁਸ਼ੀਆਂ ਮਨਾਉਂਦੇ ਹਨ ਹਰ ਇੱਕ ਤਿਉਹਾਰ 'ਤੇ ਵਧੀਆ ਗੀਤ ਗਾਏ ਜਾਂਦੇ ਹਨ ਅਤੇ ਖੁਸ਼ੀ ਮੌਕੇ ਢੋਲ ਵਜਾਏ ਜਾਂਦੇ ਹਨ ਗੀਤਕਾਰ ਵੀ ਬਹੁਤ ਚੰਗੇ ਗੀਤ ਗਾ ਕੇ ਮਨੋਰੰਜਨ ਕਰਦੇ ਹਨ ਅਤੇ ਫੇਮਸ ਕਲਾਕਾਰ ਬਾਹਰ ਜਾ ਕੇ ਗੀਤ ਗਾਉਂਦੇ ਹਨ ਜਿਸ ਨਾਲ ਉਹਨਾਂ ਦੀ ਚੜ੍ਹਾਈ ਹੁੰਦੀ ਹੈ